ਗਲੇ ਨੂੰ ਠੀਕ ਕਰਨ ਲਈ ਘਰੇਲੂ ਪੁਰਾਣੇ ਸਮੇਂ ਤੋਂ ਹੀ ਵਰਤੇ ਜਾ ਰਹੇ ਨੇ ਜਿਵੇਂ ਕਿ ਘਰਾਂ ਦੇ ਵਿੱਚ ਆਮ ਤੌਰ 'ਤੇ ਵਰਤਿਆ ਜਾਂਦਾ ਹੈ ਵੀ ਤੁਹਾਡਾ ਗਲਾ ਖਰਾਬ ਹੈ ਤਾਂ ਤੁਸੀਂ ਗਰਮ ਪਾਣੀ ਕਰਕੇ ਥੋੜ੍ਹਾ ਜਿਹਾ ਪਾਣੀ ਨਮਕ ਪਾ ਕੇ ਉਹਦੇ ਗਲਾਰੇ ਕਰਨੇ ਸਵੇਰੇ ਸ਼ਾਮ ਅਤੇ ਸ਼ਹਿਦ ਵੀ ਤੁਸੀਂ ਚੱਟ ਸਕਦੇ ਹੋ ਅਤੇ ਹੁਣ ਜਿਵੇਂ ਕਿ ਆਮ ਜੀਵਨ ਦੇ ਵਿੱਚ ਵਰਤੋਂ ਆਉਂਦੀ ਆ ਮਲੱਠੀ ਹੋਈ ਮਲੱਠੀ ਵੀ ਗਲੇ ਦੇ ਵਿੱਚ ਬਹੁਤ ਫਾਇਦੇਮੰਦ ਹੈ ਗਰਮ ਪਾਣੀ ਪੀਣ ਨਾਲ ਉਸ ਨਾਲ ਵੀ ਗਲੇ ਨੂੰ ਬਹੁਤ ਆਰਾਮ ਮਿਲਦਾ ਹੈ ਅਤੇ ਥੋੜ੍ਹੀ ਜਿਹੀ ਤੁਸੀਂ ਅਜਵਾਇਣ ਨੂੰ ਗਰਮ ਕਰਕੇ ਉਹਦੇ ਵਿੱਚ ਕਾਲਾ ਨਮਕ ਮਿਲਾ ਕੇ ਉਸਨੂੰ ਚੱਟ ਲਓ ਉਸ ਨਾਲ ਵੀ ਗਲਾ ਬਹੁਤ ਫਾਇਦਾ ਹੁੰਦਾ ਹੈ ਭਾਫ ਲੈਣੀ ਆ ਸਟਰੀਮ ਲੈ ਲਓ ਉਸ ਨਾਲ ਵੀ ਗਲੇ ਦੇ ਦਰਦ ਨੂੰ ਬਹੁਤ ਫਾਇਦਾ ਹੁੰਦਾ ਹੈ ਇਹ ਸਾਡੇ ਪੁਰਾਣੇ ਸਮਿਆਂ ਤੋਂ ਵਰਤੇ ਜਾਣ ਵਾਲੇ ਹੁਣ ਘਰੇਲੂ ਨੁਸਖੇ ਨੇ ਜੋ ਅੱਜ ਕੱਲ੍ਹ ਵੀ ਬਹੁਤ ਜ਼ਿਆਦਾ ਵਰਤੇ ਜਾਂਦੇ ਨੇ ਅਤੇ ਜੇ ਤੁਹਾਡੇ ਘਰ ਤੁਲਸੀ ਲੱਗੀ ਹੈ ਤੁਲਸੀ ਦੇ ਪੱਤੇ ਖਾ ਲਉ ਹਰ ਰੋਜ਼ ਤੁਸੀਂ ਦੋ ਪੱਤੇ ਉਸ ਨਾਲ ਤੁਹਾਡਾ ਗਲਾ ਵੀ ਠੀਕ ਰਹਿੰਦਾ ਅਤੇ ਹੋਰ ਵੀ ਸਰੀਰ ਦੇ ਪ੍ਰੋਬਲਮਾਂ ਬਹੁਤ ਜ਼ਿਆਦਾ ਠੀਕ ਰਹਿੰਦੀਆਂ ਨੇ ਜਿਵੇਂ ਸਰੀਰ ਦਾ ਕੋਈ ਵੀ ਰੋਗ ਤੁਲਸੀ ਨਾਲ ਅਨੇਕਾਂ ਰੋਗ ਠੀਕ ਰਹਿੰਦੇ ਨੇ ਅਤੇ ਜੇ ਤੁਸੀਂ ਥੋੜ੍ਹਾ ਜਿਹਾ ਨੋਨ ਵੈੱਜ ਵਾਲੇ ਪਾਸੇ ਨੂੰ ਚਲਦੇ ਹੋ ਤਾਂ ਤੁਸੀਂ ਰੱਮ ਪੀ ਸਕਦੇ ਹੋ ਗਰਮ ਪਾਣੀ ਦੇ ਵਿੱਚ ਰੱਮ ਨਾਲ ਵੀ ਬਹੁਤ ਜ਼ਿਆਦਾ ਗਲਾ ਠੀਕ ਰਹਿੰਦਾ ਇਹ ਵੀ ਇੱਕ ਦੇਸੀ ਦਵਾਈ ਦੇ ਤੌਰ ਆ ਫੌਜੀਆਂ ਨੂੰ ਦਿੱਤੀ ਜਾਂਦੀ ਆ